ਹੈਲੋ ਸਤਿ ਸ਼੍ਰੀ ਅਕਾਲ ਮੈਮ ਹੋਰ ਮੈਮ ਕਿੱਦਾਂ ਹਾਲ ਚਾਲ ਜੀ ਹਾਂਜੀ ਵਧੀਆ ਜੀ ਮੈਮ ਕੱਪੜਿਆਂ ਵਾਲੀ ਦੁਕਾਨ ਤੋਂ ਬੋਲ ਰਹੇ ਜੀ ਮੈਮ ਐਕਚੁਅਲੀ ਮੇਰੇ ਭਰਾ ਦੀ ਭਰਾ ਦਾ ਵਿਆਹ ਹੈ ਉਸ ਵਾਸਤੇ ਮੈਂ ਕੱਪੜੇ ਲੈਣੇ ਸੀ ਟਰੇਡੀਸ਼ਨਲ ਹਾਂਜੀ ਹਾਂਜੀ ਮੈਮ ਮੈਂ ਜਾਗੋ 'ਤੇ ਪਾਉਣ ਵਾਸਤੇ ਕੱਪੜੇ ਚਾਹੀਦੇ ਸੀਗੇ ਅਤੇ ਨਾਲ ਟਿੱਕਾ ਸੈੱਟ ਚਾਹੀਦਾ ਸੀ

ਮੈਮ ਘੱਗਰੇ ਜਿੱਦਾ ਗੋਲਡਨ ਲੈਸ ਵਾਲੇ ਜਿੱਦਾਂ ਦੂਜੇ ਲੰਬੇ ਕੁੜਤੇ ਨਾਲ ਟਰੈਂਡ 'ਚ ਹੈ ਉਹ ਹੈਗੇ ਹੈ ਜੀ ਹਾਂ ਅੱਛਾ ਜੀ ਹਾਂਜੀ ਮੈਮ ਅਤੇ ਬੱਚਿਆਂ ਵਾ ਵਾਲੇ ਬੱਚਿਆਂ ਲਈ ਵੀ ਮੈਂ ਲੈਣੇ ਸੀ ਕੱਪੜੇ ਗੁੜੀਆ ਵਾਸਤੇ ਲੈਣੇ ਸੀ ਉਹੀ ਟਰੈਡੀਸ਼ਨਲ ਜਾਗੋ 'ਤੇ ਪਾਉਣ ਵਾਸਤੇ ਹਾਂਜੀ ਨਾਲ ਪਰਾਂਦਾ ਅਤੇ ਦੂਜੇ ਟਿੱਕਾ ਸੈੱਟ

ਅੱਛਾ ਜੀ ਅਤੇ ਸ਼ੇਰਵਾਨੀ ਅਤੇ ਜੈਂਟਸ ਜਿੱਦਾਂ ਕੱਪੜੇ ਹਾਂਜੀ ਬੇਟੇ ਲਈ ਲੈਣੇ ਸੀ ਅਤੇ ਹਾਂਜੀ

ਜੀ ਹਾਂਜੀ ਠੀਕ ਹੈ ਮੈਮ ਫੇ ਮਤਲਬ ਕਿ ਮੈਂ ਦੇਖ ਕੇ ਜਾਊਂਗੀ ਸ਼ੋਪ 'ਤੇ ਆ ਕੇ ਜਦੋਂ ਵੀ ਮਤਲਬ ਕਦੋਂ ਤੱਕ ਖੁੱਲਾ ਹੁੰਦਾ ਸ਼ੋਪ ਤੁਹਾਡਾ ਜੀ ਠੀਕ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਓ